ਪੰਜਾਬ ਦੀ ਜਿਹੜੀ ਸਭ ਤੋਂ ਮਸ਼ਹੂਰ ਹਸਤੀ ਹੈ ਜਿਹਦੇ ਬਾਰੇ ਮੈਂ ਅੱਜ ਗੱਲ ਕਰਨ ਲੱਗੀ ਹਾਂ ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਉਹਨਾਂ ਓ ਉਹਨਾਂ ਦੇ ਉਨ੍ਹਾਂ ਬਾਰੇ ਜਿਹੜਾ ਜਾਗਰੂਕ ਨਾ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਰਹੀ ਹਾਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਤਲਬ ਉਹ ਇੱਕ ਅਜਿਹੀ ਸ਼ਖਸੀਅਤ ਨੇ ਹੈ ਨਾ ਵੀ ਜਿੰਨ੍ਹਾਂ ਵਰਗਾ ਕੋਈ ਹੋਇਆ ਹੀ ਨਹੀਂ ਅੱਜ ਤੱਕ ਹੈ ਨਾ ਵੀ ਲੋਕ ਮਤਲਬ ਕਿ ਉਨ੍ਹਾਂ ਦੇ ਜਿਹੜਾ ਉਨ੍ਹਾਂ ਦਾ ਜਿਹੜਾ ਟਾਈਮ ਸੀ ਉਨ੍ਹਾਂ ਦਾ ਕਾਲ ਸੀਗਾ ਵੀ ਉਹਦੇ ਵਿੱਚ ਹੈ ਨਾ ਉਨ੍ਹਾਂ ਦਾ ਐਨਾ ਪ੍ਰਭਾਵ ਸੀਗਾ ਲੋਕਾਂ ਦੇ ਉੱਤੇ ਹੈ ਨਾ ਵੀ ਮਤਲਬ ਵੀ ਅੰਗਰੇਜ਼ ਵੀ ਪੂਰਾ ਡਰਦੇ ਸੀਗੇ ਉਨ੍ਹਾਂ ਤੋਂ ਵੀ ਉਹ ਇੱਕ ਅਜਿਹੀ ਸ਼ਖਸੀਅਤ ਸੀਗੀ ਵੀ ਉਨ੍ਹਾਂ ਨੇ ਮਤਲਬ ਕਿ ਕਦੇ ਵੀ ਕਿਸੇ ਨਾਲ ਜਾਤ ਪਾਤ ਨੂੰ ਲੈ ਕੇ ਰੰਗ ਨਸਲ ਨੂੰ ਲੈ ਕੇ ਹੈ ਨਾ ਵੀ ਕਦੇ ਵੀ ਕੋਈ ਵੀ ਪੱਖਪਾਤ ਨਹੀਂ ਕੀਤਾ ਸੀਗਾ ਵੀ ਉਨ੍ਹਾਂ ਦੇ ਉਨ੍ਹਾਂ ਦਾ ਮਤਲਬ ਉਨ੍ਹਾਂ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਕਹਿ ਲਓ ਮਤਲਬ ਹਰੇਕ ਕੰਮ ਦੇ ਵਿੱਚ ਉਹ ਨਿਪੁੰਨ ਸੀਗੇ ਹੈ ਨਾ ਉਨ੍ਹਾਂ ਦਾ ਪ੍ਰਬੰਧਕੀ ਕੰਮ ਦੇਖ ਲਓ ਹੈ ਨਾ ਜੇ ਆਪਾਂ ਗੱਲ ਕਰੀਏ ਉਨ੍ਹਾਂ ਦੇ ਪ੍ਰਬੰਧਕ ਜਿਹੜੇ ਕੰਮ ਸੀਗੇ ਐਨੇ ਹੀ ਮੁ ਮੁਕੰਮਲ ਹੁੰਦੇ ਸੀਗੇ ਹੈ ਨਾ ਜਿਹੜਾ ਉਨ੍ਹਾਂ ਦਾ ਢਾਂਚਾ ਸੀਗਾ ਨਾ ਮਤਲਬ ਸਾਰਾ ਪ੍ਰਬੰਧਕੀ ਸੀਗਾ ਉਹ ਵੀ ਪੂਰਾ ਵਧੀਆ ਸੀਗਾ ਸਾਰੇ ਕੰਮ ਪੂਰੇ ਵਧੀਆ ਹੁੰਦੇ ਸੀਗੇ ਅਤੇ ਮਤਲਬ ਕਿ ਵੀ ਕਦੇ ਵੀ ਉਨ੍ਹਾਂ ਨੇ ਹੈ ਨਾ ਜਿਵੇਂ ਹਰੇਕ ਬੰਦੇ ਨੂੰ ਮਤਲਬ ਬਰਾਬਰ ਮੰਨ ਕੇ ਹੈ ਨਾ ਉਨ੍ਹਾਂ ਨੇ ਅਹੁਦਾ ਦਿੱਤਾ ਨਾ ਹੀ ਕਦੇ ਉਨ੍ਹਾਂ ਨੇ ਇਹ ਦੇਖਿਆ ਵੀ ਇਹ ਛੋਟੀ ਜਾਤ ਦਾ ਵੀ ਜਾਂ ਵੱਡੀ ਜਾਤ ਦਾ ਅਤੇ ਮਤਲਬ ਕਿ ਉਨ੍ਹਾਂ ਦੀ ਉਨ੍ਹਾਂ ਦੇ ਰਾਜ ਦੇ ਵਿੱਚ ਕਦੇ ਵੀ ਕੋਈ ਆਪਾਂ ਕਹਿ ਸਕਦੇ ਹਾਂ ਵੀ ਨਿਆਂ ਪੱਖੋਂ ਕੋਈ ਵੀ ਅਣ ਅਣਗੋਲਿਆਂ ਨਹੀਂ ਗਿਆ ਹੈਗਾ ਵੀ ਜਿਹੜਾ ਬੰਦਾ ਗਲਤ ਕੰਮ ਕਰਦਾ ਸੀ ਤਾਂ ਉਹਨੂੰ ਉਹਦੀ ਸਜ਼ਾ ਬਰਾਬਰ ਮਿਲਦੀ ਸੀਗੀ ਤਾਂ ਬਾਕੀ ਦੂਜੀ ਗੱਲ ਇਹ ਹੈ ਕਿ ਉਨ੍ਹਾਂ ਦੇ ਟਾਈਮ ਦੇ ਵਿੱਚ ਕੀ ਹੈ ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਵੀ ਕਾਨੂੰਨ ਜਿਹੜਾ ਅਪਰਾਧਿਕ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਦਰ ਹੈਗਾ ਬਹੁਤ ਘੱਟ ਸੀਗਾ ਕਿਉਂਕਿ ਲੋਕ ਬਹੁਤ ਡਰਦੇ ਸੀਗੇ ਬਾਕੀ ਉਨ੍ਹਾਂ ਦੀ ਜਿਹੜੀ ਨੇ ਜਿਹੜੀ ਨਿਯਮ ਪ੍ਰਣਾਲੀ ਵੀ ਸੀ ਉਹ ਐਨੀ ਮਤਲਬ ਕਿ ਸਾਫ਼ ਸੁਥਰੀ ਸੀਗੀ ਕਦੇ ਮਤਲਬ ਕਿਸੇ ਨੂੰ ਕੋਈ ਹੁੰਦਾ ਹੀ ਨਹੀਂ ਸੀਗਾ ਮਤਲਬ ਕੋਈ ਆਪਾਂ ਕਹਿ ਦੇਈਏ ਵੀ ਉਹ ਕਿਸੇ ਨੂੰ ਕੋਈ ਦਿੱਕਤ ਦਿੱਕਤ ਹੋਵੇ ਅਤੇ ਬਾਕੀ ਦੂਜੀ ਗੱਲ ਜਿਹੜੇ ਹੁਣ ਜਿਹੜੇ ਅੰਗਰੇਜ਼ ਸੀਗੇ ਹੈ ਨਾ ਵੀ ਉਹ ਵੀ ਮਤਲਬ ਕਿ ਵੀ ਹੈਰਾਨ ਹੁੰਦੇ ਸੀਗੇ ਵੀ ਹੈ ਨਾ ਵੀ ਕਿਸ ਤਰੀਕੇ ਨਾਲ ਵੀ ਸਿਸਟਮ ਹੈ ਨਾ ਵੀ ਚਲਾਇਆ ਰਿਹਾ ਮਤਲਬ ਕਿ ਇਹ ਬੰਦਾ ਹੈ ਨਾ ਵੀ ਉਹ ਮਤਲਬ ਕਿ ਆਪਣੇ ਇੱਧਰ ਪੰਜਾਬ ਦੇ ਵਿੱਚ ਹੈ ਨਾ ਵੀ ਇੱਥੇ ਆਪਣੇ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਕੰਮ ਕਰਦੇ ਸੀਗੇ ਅੰਗਰੇਜ਼ ਹੈ ਨਾ ਵੀ ਜਿਵੇਂ ਹੁਣ ਦੂਜੇ ਆਪਾਂ ਗੱਲ ਜੇ ਪੈਸੇ ਦੀ ਗੱਲ ਕਰੀਏ ਹੈ ਨਾ ਤਾਂ ਵੀ ਉਹ ਉਹ ਸਮੇਂ ਦੇ ਵਿੱਚ ਹੈ ਨਾ ਵੀ ਦੇਖੋ ਇੱਕ ਰੁਪਏ ਦੀ ਜਿਹੜੀ ਕੀਮਤ ਸੀਗੀ ਹੈ ਨਾ ਵੀ ਉਹ ਅਠਾਰਾਂ ਡਾਲਰ ਦੇ ਬਰਾਬਰ ਸੀਗੀ ਉਹ ਟਾਈਮ ਦੇ ਵਿੱਚ ਹੈ ਨਾ ਤੁਸੀਂ ਦੇਖ ਲਓ ਵੀ ਕਿੰਨਾ ਟਾਈਮ ਹੋ ਚੁੱਕਿਆ ਹੈਗਾ ਅਤੇ ਹੁਣ ਅੱਜ ਜਿਹੜੀ ਇੱਕ ਡੋਲਰ ਦੀ ਕੀਮਤ ਉਹ ਕਿੰਨੀ ਕਿੰਨੀ ਹੈਗੀ ਦੇਖ ਲਓ ਹੈ ਨਾ ਅੱਜ ਪੈਂਟ ਰੁਪਏ ਦੇ ਬਰਾਬਰ ਹੈ ਪੈਂਟ ਛਿਆਹਠ ਹੈ ਨਾ ਇੰਨੀ ਅਤੇ ਮਤਲਬ ਤੁਸੀਂ ਦੇਖੋ ਵੀ ਹੈ ਨਾ ਵੀ ਵੀ ਕਿੰਨੀ ਮਹਾਨ ਸ਼ਖਸੀਅਤ ਹੋਣੀ ਉਹਨੇ ਕਿਸ ਤਰ੍ਹਾਂ ਨਾ ਪੂਰੇ ਰਾਜ ਪ੍ਰਬੰਧ ਨੂੰ ਸੰਭਾਲਿਆ ਹੈ ਨਾ ਵੀ ਕਿਸ ਤਰੀਕੇ ਨਾਲ ਉਹਨੂੰ ਅਗਾਂਹ ਲੈ ਕੇ ਗਿਆ ਹੈ ਨਾ ਦੂਜੀ ਗੱਲ ਇਹ ਸੀਗੀ ਕਿ ਲੜਾਈਆਂ ਦੇ ਮਾਮਲੇ ਦੇ ਵਿੱਚ ਹੈ ਨਾ ਜਿਵੇਂ ਅੰਗਰੇਜ਼ ਆਪਾਂ ਨੂੰ ਪਤਾ ਹੀ ਹੈ ਉਹ ਹਮੇਸ਼ਾ ਦੋਗਲੀ ਨੀਤੀ ਨਾਲ ਹੀ ਚੱਲਦੇ ਰਹੇ ਨੇ ਹੈ ਨਾ ਉਹ ਹਮੇਸ਼ਾ ਹੀ ਮਤਲਬ ਕਿ ਲੁੱਟ ਖੋਹ ਪ੍ਰਣਾਲੀ ਮਤਲਬ ਕਿ ਇਹ ਚਲਾਇਆ ਹੈ ਨਾ ਵੀ ਕਿਵੇਂ ਨਾ ਕਿਵੇਂ ਬਸ ਲੋਕਾਂ ਅੱਗੇ ਪੰਜਾਬ ਤਾਂ ਮਤਲਬ ਆਪਾਂ ਇੱਥੋਂ ਹੈ ਨਾ ਵੀ ਲੁੱਟੀਏ ਵਪਾਰ ਕਰੀਏ ਵੀ ਬਸ ਹੈ ਨਾ ਧੀਆਂ ਭੈਣਾਂ ਇੱਜ਼ਤਾਂ ਜਿਵੇਂ ਸਾਰਾ ਕੁਛ ਵੀ ਆਪਾਂ ਸ ਦੇਖਿਆ ਹੀ ਹੈ ਨਾ ਆਪਣੇ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਪੰਜਾਬ ਇਤਿਹਾਸ ਦੇ ਵਿੱਚ ਕੀ ਕੁਝ ਵਾਪਰਿਆ ਹੈ ਨਾ ਵੰਡ ਦੇ ਸਮੇਂ ਦੇ ਦੌਰਾਨ ਦੀ ਗੱਲ ਕਰੀਏ ਜੇ ਆਪਾਂ ਤਾਂ ਮਤਲਬ ਕਿ ਉਹ ਸਾਰਾ ਜਿਹੜਾ ਸਿਸਟਮ ਸੀਗਾ ਹੈ ਨਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਆਪਾਂ ਕਹਿ ਦਈਏ ਨਾ ਵੀ ਪੂਰੇ ਜੇ ਆਪਾਂ ਪੰਜਾਬ ਇਤਿਹਾਸ ਦੀ ਗੱਲ ਕਰੀਏ ਸਭ ਤੋਂ ਜਿਹੜਾ ਵਧੀਆ ਜਿਹੜਾ ਆਪਾਂ ਕਹਿ ਦਿੰਦੇ ਹਾਂ ਨਾ ਟਾਈਮ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਸੀਗਾ ਵੀ ਅੱਜ ਤੱਕ ਇਹ ਮੰਨਿਆ ਜਾਂਦਾ ਵੀ ਹਾਂ ਵੀ ਉਹ ਮੰਨਦੇ ਨੇ ਲੋਕ ਵੀ ਹਾਂ ਵੀ ਉਹਨਾਂ ਦੀ ਬਹੁਤ ਵਧੀਆ ਪ੍ਰਣਾਲੀ ਸੀਗੀ ਉਹ ਜਿਹੜੀ ਜਿਹੜੇ ਵੀ ਉਨ੍ਹਾਂ ਨੇ ਕੰਮ ਕੁਮ ਚਾੜ੍ਹੇ ਸੀਗੇ ਨਾ ਵੀ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਜੇ ਅੰਗਰੇਜ਼ ਹੈ ਨਾ ਮਤਲਬ ਕਿ ਕੋਈ ਵੀ ਉਹ ਹਮੇਸ਼ਾ ਲੜਾਈ ਨੂੰ ਤਿਆਰ ਹੁੰਦੇ ਸੀਗੇ ਹੈ ਨਾ ਮਤਲਬ ਕਿ ਉਹ ਕੀ ਹੈ ਸਿੱਧਾ ਮਤਲਬ ਪਿੱਛੋਂ ਆਉਣਾ ਵੀ ਆਪਾਂ ਕਹਿੰਦੇ ਹਾਂ ਵੀ ਪਿੱਛੋਂ ਉਹ ਕਰਦੇ ਸੀਗੇ ਵਾਰ ਕਰਦੇ ਸੀਗੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਵੀ ਐਵੇਂ ਨਹੀਂ ਕੀਤਾ ਨਾ ਤਾਂ ਕਦੇ ਉਨ੍ਹਾਂ ਨੇ ਬੱਚੇ 'ਤੇ ਨਾ ਇਸਤਰੀ 'ਤੇ ਵਾਰ ਕੀਤਾ ਵੀ ਉਹ ਪਹਿਲਾਂ ਸੰਧੀ ਰਾਹੀਂ ਮਤਲਬ ਕਿ ਪਹਿਲਾਂ ਕੀ ਉਹ ਗੱਲਬਾਤ ਰਾਹੀਂ ਮਤਲਬ ਕਿ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸੀਗੇ ਵੀ ਵੀ ਲੜਾਈ ਨਾ ਹੀ ਕਰਨੀ ਪਵੇ ਮਤਲਬ ਕਿ ਜ਼ਿਆਦਾਤਰ ਕੀ ਹੈ ਉਨ੍ਹਾਂ ਦੇ ਟਾਈਮ ਦੇ ਵਿੱਚ ਸੰਧੀਆਂ ਹੋਈਆਂ ਨੇ ਜੇਕਰ ਉਨ੍ਹਾਂ ਨੇ ਲੜਾਈ ਲੜੀ ਵੀ ਹੈਗੀ ਹੈ ਨਾ ਤਾਂ ਉਹਦੇ ਵਿੱਚ ਉਨ੍ਹਾਂ ਨੇ ਜਿੱਤ ਹੀ ਪ੍ਰਾਪਤ ਕੀਤੀ ਹੈ ਉਹ ਵੀ ਹੁਣ ਓ ਇਨ੍ਹਾਂ ਦੀ ਮਤਲਬ ਮੁਗਲਾਂ ਦੀ ਜਾਂ ਅੰਗਰੇਜ਼ਾਂ ਦੀ ਆਪਾਂ ਕਹਿ ਸਕਦੇ ਹਾਂ ਇਨ੍ਹਾਂ ਦੀ ਨੀਤੀਆਂ ਕਰਕੇ ਹੈ ਨਾ ਕਿਉਂਕਿ ਇਨ੍ਹਾਂ ਦੀ ਦੋਗਲੀ ਨੀਤੀ ਸੀਗੀ ਇਹ ਸਾਰੀ ਤਾਂ ਮਤਲਬ ਕਿ ਇਹ ਮਹਾਰਾਜਾ ਰਣਜੀਤ ਬਾਰੇ ਹਰ ਇੱਕ ਬੱਚੇ ਨੂੰ ਹੈ ਨਾ ਹਰ ਇੱਕ ਇਨਸਾਨ ਨੂੰ ਖਾਸ ਕਰਕੇ ਪੰਜਾਬੀ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਹੈ ਨਾ ਵੀ ਉਹ ਉਨ੍ਹਾਂ ਦਾ ਆਪਣੇ ਸਿੱਖ ਇਤਿਹਾਸ ਦੇ ਵਿੱਚ ਆਪਣੇ ਪੰਜਾਬ ਇਤਿਹਾਸ ਦੇ ਵਿੱਚ ਕੀ ਯੋਗਦਾਨ ਰਿਹਾ